ਪੰਜਾਬ ਦੇ ਲੋਕਾਂ ਵਿੱਚ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਕਲਾ ਤੇ ਜੋ ਸ਼ਿਲਪਕਾਰੀ ਆ ਉਹ ਕੁੱਟ ਕੁੱਟ ਕੇ ਭਰੀ ਹੋਈ ਐ ਅੱਜ ਹਰ ਤੀਜੇ ਬੰਦੇ ਦੇ ਵਿੱਚ ਕਲਾ ਐ ਉਹਦੇ ਹੱਥ ਦੇ ਵਿੱਚ ਠੀਕ ਐ ਉਹ ਕੁਝ ਨਾ ਕੁਝ ਆਪਦਾ ਟੈਲੈਂਟ ਸ਼ੋ ਕਰਦਾ ਠੀਕ ਐ ਇਸ ਲਈ ਜਿਵੇਂ ਪੰਜਾਬ ਦੇ ਵਿੱਚ ਕੀ ਐ ਬਰਤਨਾਂ ਦੀ ਬਨਾਵਟ ਹੋ ਗਈ ਸਲਾਈ ਕੜਾਈ ਹੋ ਗਈ ਠੀਕ ਐ ਔਰ ਲੱਕੜ ਦੇ ਜਿਹੜੇ ਹਨਾ ਸਮਾਨ ਹੋ ਗਿਆ ਉਹਨੂੰ ਕਿਵੇਂ ਬਣਾਇਆ ਜਾ ਰਿਹਾ ਹੈਗਾ ਉਹਨੂੰ ਐਜ਼ ਸਜਾਵਟ ਦੀ ਚੀਜ਼ਾਂ ਵਜੋਂ ਕਿਵੇਂ ਉਹਨੂੰ ਯੂਜ਼ ਕੀਤਾ ਜਾ ਸਕੇ ਮਿਊਜ਼ੀਅਮ ਦੇ ਵਿੱਚ ਜਿਵੇਂ ਹੁਣ ਪੰਜਾਬ ਦੀਆਂ ਮਤਲਬ ਲੋਕਾਂ ਦੁਆਰਾ ਬਣਾਈਆਂ ਗਈਆਂ ਜਿਹੜੇ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕਿਵੇਂ ਰੱਖਿਆ ਜਾ ਰਿਹਾ ਹੈਗਾ ਤਾਂ ਕੀ ਆ ਉਹ ਜੋ ਮਤਲਬ ਪੰਜਾਬ ਦੇ ਲੋਕਾਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਹੁੰਦੀਆਂ ਹੈਗੀਆਂ ਠੀਕ ਐ ਉਹ ਇੱਕ ਐਗਜੀਬਿਸ਼ਨ ਜਦੋਂ ਲੱਗਦੀ ਉਹਨਾਂ ਦੀ ਤਾਂ ਉਹ ਕੀ ਐ ਵੱਡੇ ਪੱਧਰ ਤੇ ਉਹਨਾਂ ਦੀ ਕਿ ਸੇਲ ਹੁੰਦੀ ਹੈਗੀ ਆ ਜਿਹਦੇ ਨਾਲ ਕਿ ਲੋਕ ਆਪਦਾ ਕੀ ਹੈ ਆਪਦੇ ਕੀ ਰੋਜ਼ਗਾਰ ਦੇ ਸਾਧਨ ਜਿਹੜੇ ਹੈਗੇ ਬਣਾ ਰਹੇ ਹੈਗੇ ਆ ਤਾਂ ਪੰਜਾਬ ਦੇ ਲੋਕਾਂ ਦੀ ਜੋ ਕਲਾ ਤੇ ਸ਼ਿਲਪਕਾਰੀ ਹੈਗੀ ਐ ਠੀਕ ਐ ਉਹ ਕਿਤੇ ਨਾ ਕਿਤੇ ਪੂਰੇ ਇੰਡੀਆ ਦੇ ਲਈ ਕਿ ਐ ਮਤਲਬ ਉਹਦੀ ਅਮੀਰੀ ਜੋ ਹੈਗੀ ਐ ਉਹਦੀ ਉਹਨੂੰ ਹੈਲਥ ਤੇ ਵੈਲਥ ਨੂੰ ਉਹਦੇ ਦਰਸਾਉਂਦੀ ਹੈਗੀ ਐ ਜੋ ਪੰਜਾਬ ਦੇ ਲੋਕਾਂ ਦੀ ਕਲਾਕਾਰੀ ਹੈਗੀ ਐ ਠੀਕ ਐ ਉਹ ਜੋ ਆਪਦੇ ਬਣਾਉਂਦੇ ਹੈਗੇ ਹੱਥਾਂ ਨਾਲ ਠੀਕ ਐ ਉਹ ਅੱਗੋਂ ਸੇਲ ਕਰਦੇ ਹੈਗੇ ਐ ਠੀਕ ਐ ਹੁਣ ਕਈ ਵਿਦੇਸ਼ੀ ਜਿਹੜੇ ਹੈਗੇ ਉਹ ਆ ਕੇ ਚੀਜ਼ਾਂ ਉਹਨਾਂ ਚੀਜ਼ਾਂ ਨੂੰ ਖਰੀਦਦੇ ਹੈਗੇ ਆ ਕਲਾ ਕ੍ਰੀਤੀਆਂ ਵਾਲੀਆਂ ਚੀਜ਼ਾਂ ਨੂੰ ਬਹੁਤ ਜਿਆਦਾ ਐਟਰੈਕਟ ਕਰਦੀਆਂ ਉਹਨੂੰ ਨੂੰ ਠੀਕ ਐ ਉਹ ਖਰੀਦਦੇ ਹੈਗੇ ਐ ਜਿਹਦੇ ਨਾਲ ਕੀ ਐ ਭਾਰਤ ਦੀ ਜਿਹੜੀ ਹੈਗੀ ਐ ਉਹ ਆਰਥਿਕ ਵਿਵਸਥਾ ਹੈ ਕੀ ਐ ਮਜਬੂਤ ਹੁੰਦੀ ਹੈਗੀ ਤੇ ਉਹ ਮਤਲਬ ਆਪਦੇ ਜੋ ਹੈਗੇ ਆਪਦੇ ਪੈਸੇ ਤੇ ਜੋ ਮਤਲਬ